ਰੋਜ਼ ਮਰਿਆ ਦੇ ਕੰਮਾਂ ਵਿੱਚ ਪੇਂਡੂ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ ਜਿਵੇਂ ਕਿ ਕਈ ਵਾਰੀ ਜਦੋਂ ਉਹਨਾਂ ਨੂੰ ਵੱਖ ਵੱਖ ਤਰੀਕਿਆਂ ਦੇ ਗਰਾਂਟ ਚਾਹੀਦੇ ਹਨ ਅਤੇ ਉਦੋਂ ਉਹਨਾਂ ਨੂੰ ਸਿੱਧਾ ਮੂੰਹ 'ਤੇ ਮਨ੍ਹਾ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਗਰਾਂਟਸ ਨਹੀਂ ਲੈ ਸਕਦੇ ਕਿਉਂਕਿ ਕੋਈ ਨਾ ਕੋਈ ਕ ਵੱਖ ਵੱਖ ਰੀਜਨ ਲੈ ਕੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੈ ਅਤੇ ਇਵੇਂ ਹੀ ਜੇ ਉਹਨਾਂ ਨੇ ਅਦਾਲਤ ਜਾਂ ਪੁਲਿਸ ਸਟੇਸ਼ਨ ਜਾਣਾ ਹੁੰਦਾ ਸੀ ਤਾਂ ਉਹਨਾਂ ਦੇ ਨੇੜੇ ਕੋਈ ਵੀ ਇੱਦਾਂ ਦੀ ਫੈਸਿਲਿਟੀ ਨਹੀਂ ਹੁੰਦੀ ਜਿਸ ਕਰਕੇ ਉਹਨਾਂ ਨੂੰ ਬਹੁਤ ਬਹੁਤ ਦੂਰ ਤੱਕ ਪਰੇਸ਼ਾਨੀਆਂ ਫੇਸ ਕਰਨੀਆਂ ਪੈਂਦੀਆਂ ਹਨ ਉਹਨਾਂ ਨੂੰ ਰੋਜ਼ ਰੋਜ਼ ਦੂਰ ਦੂਰ ਜਾਣਾ ਪੈਂਦਾ ਹੈ ਸੋ ਦੈਟ ਉਹ ਆਪਣਾ ਕੰਮ ਆਰਾਮ ਨਾਲ ਕਰ ਸਕਣ